ਹਰ ਇੱਕ ਦੀ ਜ਼ਿੰਦਗੀ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਟਰਾਇਲ ਜਾਂ ਰੂਟ ਹੁੰਦੇ ਹਨ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹਾ ਹੀ ਹੈ ਮੈਨ ਮੈਂ ਆਪਣੇ ਸਾਈਕਲ ਰਾਹੀਂ ਪਹਾੜਾਂ ਵੱਲ ਰੂਟ ਕੀਤੇ ਹਨ ਮੈਨੂੰ ਪਹਾੜਾਂ ਵੱਲ ਰੂਟ ਕਰਨੇ ਬਹੁਤ ਹੀ ਪਸੰਦ ਹਨ ਅਤੇ ਜਦੋਂ ਮੈਂ ਚੰਡੀਗੜ੍ਹ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਮੈਂ ਆਪਣੇ ਸੈਂਕੜ ਰਾਹੀਂ ਸਾਰੇ ਚੰਡੀਗੜ੍ਹ ਸ਼ਹਿਰ ਦਾ ਰੂਟ ਕੱਢਿਆ ਹੈ ਅਤੇ ਮੈਂ ਆਪਣੇ ਸੈਂਕਡ ਰਾਹੀਂ ਹੀ ਚੰਡੀਗੜ੍ਹ ਤੋਂ ਸ਼ਿਮਲਾ ਮਨਾਲੀ ਕਸੂਰੀ ਅਲੱਗ ਅਲੱਗ ਥਾਵਾਂ 'ਤੇ ਰੂਟ ਕੱਢ ਚੁੱਕਿਆ ਹਾਂ ਮੈਨੂੰ ਸਾਈਕਲ ਰਾਹੀਂ ਸਟੰਟ ਕਰਨੇ ਵੀ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਆਪਣੇ ਸਾਈਕਲ ਰਾਹੀਂ ਬਹੁਤ ਹੀ ਸਟੰਟ ਕੀਤੇ ਹਨ ਜਿਵੇਂ ਸਾਈਕਲ ਸਟੰਟ ਜੰਪ ਕਰਵਾਉਣਾ ਸਲਿਪ ਕਰਵਾਉਣਾ ਅਤੇ ਮੈਂ ਕਈ ਸਟੰਟ ਕੁਝ ਸਟੰਟ ਅਜਿਹੇ ਵੀ ਹਨ ਜੋ ਮੈਂ ਪਹਾੜਾਂ 'ਤੇ ਕੀਤੇ ਹਨ ਜਿਸ ਤਰ੍ਹਾਂ ਕਿ ਸਾਈਕਲ ਸਾਈਕਲ ਦੀ ਸਪੀਡ ਤੇਜ਼ ਕਰਕੇ ਪਹਾੜ ਉੱਪਰ ਚੜ੍ਹ ਜਾਣਾ ਅਤੇ ਉਸ ਤੋਂ ਬਾਅਦ ਇੱਕ ਪਹਾੜ ਤੋਂ ਦੂਸਰੇ ਪਹਾੜ ਤੱਕ ਸਟੰਟ ਕਰਨਾ ਮਤਲਬ ਕੋਈ ਜ਼ਿਆਦਾ ਨਹੀਂ ਠੀਕ ਜੇ ਪਹਾੜ ਤੋਂ ਸਟੰਟ ਕਰਨਾ ਅਤੇ ਇੱਕ ਅਤੇ ਦੂਜੇ ਪਹਾੜ ਤੋਂ ਪਹਿਲੇ ਪਹਾੜ ਤੋਂ ਦੂਜੇ ਪਹਾੜ ਤੱਕ ਜਿਵੇਂ ਕਿ ਸਟੰਟ ਕਰਨਾ ਜਿਵੇਂ ਕਿ ਪਹਾੜ ਤੋਂ ਥੱਲੇ ਆਉਣਾ ਸੈਂਕਲ ਰਾਹੀਂ ਜਾਂ ਉੱਪਰ ਚੜ੍ਹਨਾ ਕੁਝ ਐਸਾ ਅਤੇ ਮੈਨੂੰ ਸਾਇਕਲ ਰਾਹੀਂ ਰੇਸਿੰਗ ਕਰਨੀ ਵੀ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਕਈ ਮੈਰਾਥੋਨ ਰੇਸ ਵਿੱਚ ਵੀ ਜਾ ਚੁੱਕਿਆ ਹਾਂ